ਹਾਂਜੀ ਹੈਲੋ ਤੁਸੀਂ ਫਲਿੱਪਕਾਰਟ ਕਸਟਮਰ ਕੇਅਰ ਤੋਂ ਬੋਲਦੇ ਹੋ ਹਾਂਜੀ ਮੈਂ ਮੇਰਾ ਨਾਮ ਨਾ ਆਸ਼ੀਸ਼ ਆ ਅਤੇ ਮੈਂ ਪਿਛਲੇ ਹਫ਼ਤੇ ਤੁਹਾਡੇ ਕੋਲੋਂ ਆਰਡਰ ਬੁੱਕ ਕਰਾਇਆ ਸੀਗਾ ਜਿਹਦਾ ਆਰਡਰ ਨੰਬਰ ਸੀਗਾ ਨੌਂ ਇੱਕ ਛੇ ਪੰਜ ਚਾਰ ਤਿੰਨ ਸੱਤ ਅੱਠ ਨੌਂ ਇੱਕ ਦੋ ਇਹ ਮੈਂ ਜੀ ਬਠਿੰਡੇ ਨਿਵਾਸ ਕਰਦਾ ਵਾਂ ਅਤੇ ਨਾਲੇ ਮੈਂ ਆਰਡਰ ਕੀਤਾ ਸੀ ਤੁਹਾਡੇ ਕੋਲੋਂ ਆਪਣੇ ਏਅਰਫੋਨ ਅਤੇ ਉਹਨਾਂ ਦੀ ਕੁਆਲਿਟੀ ਇੰਨੀ ਵਧੀਆ ਅਤੇ ਇੰਨੀ ਲੋਂਗ ਲਾਸਟਿੰਗ ਬੈਟਰੀ ਉਹਨਾਂ ਦੀ ਮੈਂ ਕੀ ਦੱਸਾਂ ਮੈਂ ਤਾਂ ਬਹੁਤ ਖੁਸ਼ ਹਾਂ ਜੀ ਤੁਹਾਡੇ ਏਅਰਫੋਨਸ ਦੇਖ ਕੇ ਭਈ ਮੈਂ ਉਹਨੂੰ ਲਗਾਤਾਰ ਕੰਟੀਨਿਊ ਤੁਸੀਂ ਮੰਨੋ ਮੈਂ ਦੋ ਕੁ ਦਿਨ ਮੈਂ ਕੰਟੀਨਿਊ ਚਲਾਇਆ ਵਾ ਅਤੇ ਦੋ ਦਿਨ ਦੇ ਵਿੱਚ ਉਹਦੀ ਬੈਟਰੀ ਪੂਰੀ ਮੇਰੇ ਸਪੋਰਟ 'ਚ ਰਹੀ ਆ ਮੈਨੂੰ ਬੜੀ ਨੀਡ ਸੀਗੀ ਇਹਦੀ ਤੁਸੀਂ ਮੰਨੋ ਲਾਇਬ੍ਰੇਰੀ ਦੇ ਵਿੱਚ ਮੈਂ ਬਹਿੰਦਾ ਸੀਗਾ ਅਤੇ ਨਾਲੇ ਮੈਨੂੰ ਡਿਸਟਰਬੈਂਸ ਜਿਹੀ ਹੁੰਦੇ ਸੀ ਜਿਵੇਂ ਕੋਈ ਨੇੜੇ ਤੇੜੇ ਬਹਿੰਦਾ ਵਾ ਅਤੇ ਉਹ ਆਪਣੀ ਗੱਲਾਂ ਕਰਦੇ ਆ ਥੋੜ੍ਹੀ ਜਿਹੀ ਤਾਂ ਉਹਦੇ ਕਰਕੇ ਡਿਸਟਰਬੈਂਸ ਹੁੰਦੀ ਸੀ ਲੇਕਿਨ ਇਹਦੀ ਲੋਇ ਨੋਇਸ ਕੈਂਸਲੇਸ਼ਨ ਇੰਨੀ ਵਧੀਆ ਵਾ ਜੇਕਰ ਆਪਾਂ ਲਾ ਲਏ ਏਅਰਫੋਨ ਲਾਏ ਹੋਏ ਆ ਤਾਂ ਫਿਰ ਬਾਹਰ ਦੀ ਜੇਕਰ ਨੋਇਸ ਨਾ ਉਹ ਡਿਸਟਰਬ ਨਹੀਂ ਕਰਦੀ ਸਾਨੂੰ ਸੀਰੀਅਸਲੀ ਇੱਕ ਨਾਲੇ ਇੱਕ ਤਾਂ ਤੁਹਾਡੀ ਡਿਲੀਵਰੀ ਸਰਵਿਸ ਮੈਨੂੰ ਇੰਨੀ ਵਧੀਆ ਲੱਗੀ ਤੁਸੀਂ ਉੱਥੇ ਤੁਸੀਂ ਸ਼ੋ ਕਰਦੇ ਪਏ ਸੀ ਕਿ ਮੈਨੂੰ ਇੱਕ ਹਫ਼ਤੇ ਦੇ ਵਿੱਚ ਡਿਲੀਵਰੀ ਮਿਲੂਗੀ ਜਿਹੜੇ ਮੇਰੇ ਏਅਰਫੋਰਨ ਹੈਗੇ ਆ ਅਤੇ ਨਾਲੇ ਤੁਸੀਂ ਮੰਨੋਗੇ ਨਹੀਂ ਬਿਲੀਵ ਨਹੀਂ ਕਰੋਗੇ ਤੁਸੀਂ ਤਿੰਨ ਦਿਨ ਦੇ ਵਿੱਚ ਡਿਲੀਵਰੀ ਕੀਤੀ ਮੈਂ ਤਾਂ ਬਾਹਲਾ ਖੁਸ਼ ਹਾਂ ਤੁਹਾਡੀ ਸਰਵਿਸ ਤੋਂ ਨਾਲੇ ਮੈਂ ਮੰਨੋ ਤੁਸੀਂ ਤੁਹਾਡੇ ਕਸਟਮਰ ਵੀ ਵਧਾ ਤੇ ਇੱਕ ਤਰੀਕੇ ਨਾਲ ਮੇਰੇ ਨਾਲ ਦੋਸਤਾਂ ਨੇ ਵੀ ਮੇਰੇ ਤੋਂ ਯੂਜ਼ ਕੀਤਾ ਇਹ ਏਅਰਫੋਨ ਮੇਰੇ ਲਏ ਮੇਰੇ ਦੋਸਤਾਂ ਨੇ ਅਤੇ ਉਹਨਾਂ ਨੇ ਬੋਲਿਆ ਕਿ ਆਪਾਂ ਵੀ ਦੇਖੀਏ ਕਿਵੇਂ ਦੇ ਵਰਤਦੇ ਆ ਤੁਸੀਂ ਕਿਵੇਂ ਦੇ ਹੈਗੇ ਏਅਰਫੋਨ ਅਤੇ ਉਹਨਾਂ ਨੂੰ ਇੰਨੇ ਵਧੀਆ ਲੱਗੇ ਏਅਰਫੋਨ ਉਹਨਾਂ ਨੇ ਵੀ ਮੇਰੇ ਤੋਂ ਆਰਡਰ ਕਰਾਏ ਹੈਗੇ ਆ ਏਅਰਫੋਨ ਥੈਂਕ ਯੂ ਵੈਰੀ ਮੱਚ ਜੀ ਤੁਹਾਡੇ ਵੱਲੋਂ ਬਹੁਤ ਵਧੀਆ ਪ੍ਰੋਡਕਟ ਡਿਲੀਵਰ ਹੋਇਆ ਮੈਨੂੰ